ਮੈਂ ਆਪਣੇ ਮਨ 'ਚ ਹੀ ਸੋਚ ਲੈਂਦੀ ਹਾਂ ਕਿ ਮੈਂ ਕੀ ਬਣਾਉਣਾ ਮੈਂ ਆਪਣੇ ਦਿਮਾਗ ਨਾਲ ਹੀ ਈਮੈਜੀਨੇਸ਼ਨ ਨਾਲ ਹੀ ਕਲਪਨਾ 'ਚ ਹੀ ਸੋਚ ਲੈਂਦੀ ਹਾਂ ਕਿ ਮੈਂ ਅੱਜ ਇਹ ਬਣਾਉਣਾ ਜਿਵੇਂ ਮੰਨ ਲਓ ਮੌਸਮ ਵਧੀਆ ਆ ਤਾਂ ਮੈਂ ਉਸ ਦੇ ਉੱਤੇ ਹੀ ਪੇਟਿੰਗ ਬਣਾਉਣੀ ਪਸੰਦ ਕਰਾਂਗੀ ਜਾਂ ਮੈਂ ਜੇ ਕਿੱਧਰੇ ਪਹਾੜੀ ਸਥਾਨ 'ਤੇ ਗਈ ਹਾਂ ਜਾਂ ਮੈਂ ਕੋਈ ਨੈਚੂਰਲ ਸੀਨ ਦੇਖ ਰਹੀ ਹਾਂ ਤਾਂ ਮੈਂ ਉੱਥੇ ਦੇ ਸੀਨ ਨੂੰ ਮਨ 'ਚ ਵਸਾ ਕੇ ਅਤੇ ਉਹਦੇ ਬਾਰੇ ਹੀ ਆ ਉਹ ਪੇਟਿੰਗ ਵਗੈਰਾ ਬਣਾਉਣ ਦਾ ਸੋਚ ਲੈਂਦੀ ਹਾਂ ਅਤੇ ਮੈਂ ਵਿਸ਼ਾ ਜੋ ਹੈ ਕੁਦਰਤ ਨੂੰ ਲੈਣਾ ਪਸੰਦ ਕਰਦੀ ਹਾਂ ਥੀਮ ਮੇਰਾ ਕੁਦਰਤ ਹੀ ਹੁੰਦਾ ਹੈ